ਮੈਂ ਆਪਣੇ ਨੇੜਲੇ ਪਿੰਡ ਬੈਕਾ ਵਿੱਚ ਗਈ ਜਿੱਥੇ ਮੇਰੀ ਨਾਨਕੀ ਜਮੀਨ ਹੈ ਉੱਥੇ ਮੇਰੇ ਨ ਮਾਮਾ ਜੀ ਦਾ ਲੜਕਾ ਨੰਬਰਦਾਰ ਹੈ ਉਸ ਦੇ ਨਾਲ ਮੈਂ ਘਰ ਘਰ ਵਿੱਚ ਜਾ ਕੇ ਕੁੜੀਆਂ ਨੂੰ ਵਿੱਦਿਆ ਬਾਰੇ ਜਾਗਰੂਕ ਕੀਤਾ ਉਹਨਾਂ ਨੂੰ ਸਮਝਾਇਆ ਕਿ ਵਿੱਦਿਆ ਦਾ ਜੀਵਨ ਵਿੱਚ ਕੀ ਮਹੱਤਵ ਹੈ ਜੇ ਕੁੜੀਆਂ ਪੜ੍ਹੀਆਂ ਲਿਖੀਆਂ ਹੋਣਗੀਆਂ ਤਾਂ ਆਪ ਕੱਲ੍ਹ ਨੂੰ ਆਪਣੇ ਬੱਚਿਆਂ ਨੂੰ ਵੀ ਚੰਗੀ ਤਰ੍ਹਾਂ ਸਿੱਖਿਆ ਦੇ ਪਾਉਣਗੀਆਂ ਉਹਨਾਂ ਦੀ ਜਿਹੜੀ ਸ਼ਾਦੀ ਹੈ ਜੇ ਪੜ੍ਹੀਆਂ ਲਿਖੀਆਂ ਹੋਣਗੀਆਂ ਤਾਂ ਚੰਗੇ ਘਰਾਂ 'ਚ ਪੜ੍ਹੇ ਲਿਖੇ ਮੁੰਡਿਆਂ ਨਾਲ ਹੋ ਪਾਵੇਗੀ ਉਹਨਾਂ ਦੀ ਕੁੜੀਆਂ ਦੇ ਮਾਂ ਬਾਪ ਜਿਹੜੇ ਸਿੱਖਿਆ ਦੇ ਖਿਲਾਫ ਸੀ ਉਹਨਾਂ ਨੂੰ ਜਾਗਰੂਕ ਕੀਤਾ ਜਾ ਕੇ ਉਹਨਾਂ ਨੂੰ ਸਿੱਖਿਆ ਦੇ ਮੰਤਵਾਂ ਬਾਰੇ ਦੱਸਿਆ ਮੇਰਾ ਮੇਨ ਉਦੇਸ਼ ਹੀ ਕੁੜੀਆਂ ਨੂੰ ਵਿੱਦਿਆ ਦੇ ਬਾਰੇ ਜਾਗਰੂਕ ਕਰਨਾ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਦੀਆਂ ਪੜ੍ਹਾਈ ਦੇ ਬਾਰੇ ਜਾਣਕਾਰੀ ਦਿੱਤੀ ਜੇ ਕੁੜੀਆਂ ਪੜ੍ਹ ਨਹੀਂ ਸਕਦੀਆਂ ਤਾਂ ਉਹਨਾਂ ਨੂੰ ਕਿਹੜੀਆਂ ਕਲਾਵਾਂ ਵਿੱਚ ਲੈ ਕੇ ਪੈਸੇ ਕਮਾ ਸਕਦੀਆਂ ਹਨ ਅਤੇ ਬੇਰੁਜ਼ਗਾਰੀ ਨੂੰ ਇਸ ਨਾਲ ਖਤਮ ਕੀਤਾ ਜਾ ਸਕਦਾ ਹੈ ਕਿਉਂਕਿ ਜੇ ਕੁੜੀਆਂ ਪੜ੍ਹੀਆਂ ਲਿਖੀਆਂ ਹੋਣਗੀਆਂ ਤਾਂ ਆਪਣੇ ਮਾਂ ਬਾਪ ਨੂੰ ਸਸੁਰਾਲ ਵਿੱਚ ਸਭ ਨੂੰ ਚੰਗੀ ਵਿੱਦਿਆ ਦੇ ਪਾਉਣਗੀਆਂ ਉਹਨਾਂ ਨੂੰ ਚੰਗੇ ਪ ਪੈਸੇ ਨੂੰ ਕਿਵੇਂ ਪ੍ਰਯੋਗ ਕਰਨਾ ਕਿਵੇਂ ਆਪਣੀ ਸਹੀ ਪੜ੍ਹਾਈ ਕਰਨੀ ਹੈ ਅਤੇ ਬੱਚਿਆਂ ਨੂੰ ਆਪਣੇ ਸਹੀ ਪੜ੍ਹਾਈ ਕਰਵਾਉਣ ਦੇ ਯੋਗ ਬਣਾ ਸਕਣਗੀਆਂ